ਹਾਂਜੀ ਮੈਂ ਕੋਲਜ ਟਾਈਮ ਖਾਣਾ ਪਕਾਉਣ ਦੀ ਰੈਸਪੀ ਇਹਦੇ ਵਿੱਚ ਪਾਰਟੀਸੀਪੇਟ ਕੀਤਾ ਸੀ ਉਸ ਟਾਈਮ ਹੈਗੀ ਸੀ ਖਾਣਾ ਬਣਾਉਣ ਦੀ ਰੈਸਿਪੀ ਡੋਕਲਾ ਉਹਦੇ ਵਿੱਚ ਮੇਰਾ ਉਸ ਟਾਈਮ ਦੂਜਾ ਸਥਾਨ ਆਇਆ ਸੀ ਅਤੇ ਮਤਲਬ ਉਸਨੂੰ ਜਦੋਂ ਮੇਰੀ ਉਹ ਰੈਸਿਪੀ ਨੂੰ ਦੂਜਾ ਸਥਾਨ ਆਇਆ ਉਸ ਤੋਂ ਬਾਅਦ ਮੈਂ ਉਹਨੂੰ ਯੂਟਿਊਬ 'ਤੇ ਫੇਸਬੁੱਕ 'ਤੇ ਸ਼ੇਅਰ ਕੀਤਾ ਤਾਂ ਮੇਰੇ ਕਾਫੀ ਫੋਲੋਅਰਸ ਬਣੇ ਉਸ ਤੋਂ ਬਾਅਦ ਮੈਂ ਬਹੁਤ ਸਾਰੀਆਂ ਰੈਸੀਪੀਆਂ ਨੂੰ ਵੀ ਸ਼ੇਅਰ ਕੀਤਾ ਜਿਵੇਂ ਖੀਰ ਬਣਾਉਣਾ ਹੋ ਗਈ ਮਤਲਬ ਖੀਰ ਬਣਾਉਣਾ ਹੋ ਗਈ ਜਿਵੇਂ ਕਿ ਸ਼ਾਹੀ ਪਨੀਰ ਹੋ ਗਿਆ ਮਿਕਸ ਵੈੱਜ ਹੋ ਗਈ ਇਡਲੀ ਸਾਂਬਰ ਹੋ ਗਿਆ ਬਹੁਤ ਸਾਰਾ ਬਹੁਤ ਜ਼ਿਆਦਾ ਮੈਨੇ ਵੀਡੀਓਜ਼ ਬਣਾਈਆਂ ਬਟ ਮੈਨੂੰ ਆਪਣੇ ਘਰੇੇਲੂ ਰੁਝੇਵਿਆਂ ਕਾਰਨ ਮੇਰੇ ਉਨ੍ਹਾਂ 'ਤੇ ਨਹੀਂ ਫੋਲੋਅਰਸ ਬਣ ਸਕੇ ਬਟ ਮੈਨੂੰ ਉਮੀਦ ਹੈ ਜਦੋਂ ਵੀ ਮੈਨੂੰ ਟਾਈਮ ਲੱਗਿਆ ਮੈਂ ਹੋਰ ਰੈਸਪੀ ਸ਼ੇਅਰਸ ਕਰਾਂਗੀ ਅਤੇ ਮੇਰੇ ਹੋਰ ਫੋਲੋਅਰਸ ਬਣਨਗੇ ਥੈਕ ਯੂ